ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕੱਪੜੇ ਵਿੱਚ ਬਹੁਤ ਤਬਦੀਲੀ ਆ ਰਹੀ ਹੈ ਕੁੜੀਆਂ ਜ਼ਿਆਦਾਤਰ ਸਲਵਾਰ ਸੂਟ ਪਹਿਨ ਦੀਆਂ ਹਨ ਅਤੇ ਕੁੜੀਆਂ ਦੇ ਸਿਰ ਉੱਤੇ ਚੁੰਨੀ ਲਈ ਹੁੰਦੀ ਹੈ ਜ਼ਿਆਦਾ ਸ਼ਿੰਗਾਰ ਨਹੀਂ ਕਰਦੀਆਂ ਬਸ ਸਾਧਰਨ ਕੁੜੀਆਂ ਹਨ ਜਦੋਂ ਕੋਈ ਪ੍ਰੋਗਰਾਮ ਵਿਆਹ ਸ਼ਾਦੀ ਹੁੰਦੀ ਹੈ ਤਾਂ ਕੁੜੀਆਂ ਉਹ ਉਸ ਸਮੇਂ ਸ਼ਿੰਗਾਰ ਕਰਦੀਆਂ ਹਨ ਉਹ ਸ਼ਿੰਗਾਰ ਤੋਂ ਚੁੰਨੀ ਨਹੀਂ ਲਾਹਉਂਦੀਆਂ ਹਨ ਇਹ ਸਾਡਾ ਬਹੁਤ ਪੁਰਾਣਾ ਸੱਭਿਆਚਾਰ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸਿਰ 'ਤੇ ਚੁੰਨੀ ਨਾ ਦਿਓ